ਹੈਲੋ ਹਾਂਜੀ ਤੁਸੀ ਕੌਣ ਬੋਲ ਰਹੇ ਜੀ ਹਾਂਜੀ ਹਰਮਨਪ੍ਰੀਤ ਸਿੰਘ ਆਪਣੇ ਹਰਗੁਣ ਦੇ ਪਾਪਾ ਹਾਂਜੀ ਮੈਂ ਹਰਗੁਣ ਬਾਰੇ ਹੀ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਸਨ ਜੀ ਮੈਂ ਉਹਦੇ ਸਕੂਲ ਤੋਂ ਬੋਲਦੀ ਹਾਂ ਜੀ ਮੈਂ ਉਹਦੀ ਕਲਾਸ ਇੰਚਾਰਜ ਹਾਂ ਹਾਂਜੀ ਅਤੇ ਮੈਂ ਉਹਦੇ ਉਹਦੀ ਪੜ੍ਹਾਈ ਬਾਰੇ ਤੁਹਾਡੇ ਨਾਲ ਕੁਛ ਕੁਝ ਡਿਸਕਸ਼ਨ ਕਰਨੀ ਆ ਕਿ ਕੱਲ੍ਹ ਇਹ ਪੇਰੈਂਟਸ ਮੀਟ ਸੀ ਸਾਡੇ ਸਕੂਲ ਵਿੱਚ ਤੁਸੀਂ ਆਏ ਨਹੀਂ ਹਾਂ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਜਾਣ ਜਾ ਕੇ ਅਸੀਂ ਵੀ ਕੋਈ ਵੀ ਇਹੋ ਜਿਹਾ ਦਿਨ ਰੱਖਾਂਗੇ ਜਿਸ ਦਿਨ ਛੁੱਟੀ ਹੋਵੇ ਠੀਕ ਹੈ ਜੀ ਅਤੇ ਇਸ ਵਾਰੀ ਥੋੜ੍ਹੀਆਂ ਜਿਹੀਆਂ ਕੁਝ ਡਿਸਕਸ਼ਨ ਜਿਹੀ ਕਰਨੀਆਂ ਹੁੰਦੀਆਂ ਨੇ ਬੱਚਿਆਂ ਬਾਰੇ ਅਤੇ ਉਹ ਤੁਹਾਡੇ ਨਾਲ ਮਿਲ ਕੇ ਹੋ ਸਕਦੇ ਨੇ ਇਸ ਤਰ੍ਹਾਂ ਹੈ ਕਿ ਹਰਗੁਨ ਪਹਿਲੇ ਤਾਂ ਕਾਫੀ ਠੀਕ ਚੱਲ ਰਿਹਾ ਸੀ ਬਾਕੀ ਪੇਪਰ ਉਹਦੇ ਤਾਂ ਵਧੀਆ ਹੋਏ ਜੇ ਇੱਕ ਮੈਥ ਵਿੱਚੋਂ ਪਿੱਛੇ ਜਾ ਰਿਹਾ

ਵੈਸੇ ਦੇਖੋ ਜੀ ਮੈਡਮ ਤਾਂ ਮਿਹਨਤੀ ਨੇ ਕਾਫੀ ਮਿਹਨਤੀ ਹੈ ਅਤੇ ਬੱਚੇ ਵੀ ਕਈ ਵਾਰੀ ਜਾਣ ਬੁੱਝ ਕੇ ਵੀ ਸ਼ਿਕਾਇਤਾਂ ਕਰਦੇ ਨੇ ਉਹ ਖੁਦ ਪਿੱਛੇ ਜਾ ਰਿਹਾ ਕਲਾਸ ਵਿੱਚ ਧਿਆਨ ਨਹੀਂ ਦੇ ਰਿਹਾ ਮੈਡਮ ਕਹਿੰਦੇ ਨੇ ਕਿ ਜਦੋਂ ਵੀ ਮੈਂ ਪੜ੍ਹਾ ਰਹੀ ਹੁੰਦੀ ਹਾਂ ਤਾਂ ਇਹਦਾ ਧਿਆਨ ਇੱਧਰ ਉੱਧਰ ਹੋ ਜਾਂਦਾ ਜੀ ਹਾਂ ਅਸੀਂ ਸਿਰਫ ਟੀਚਰ ਉੱਤੇ ਨਹੀਂ ਬਲੇਮ ਕਰ ਸਕਦੇ ਕਈ ਵਾਰੀ ਦੇਖੋ ਜੀ ਬੱਚੇ ਵੀ ਗਲਤ ਹੋ ਜਾਂਦੇ ਆ ਇਸ ਕਰਕੇ ਤੁਸੀਂ ਖੁਦ ਹੀ ਆਓ ਅਤੇ ਬਹੁਤ ਵਧੀਆ ਗੱਲ ਹੈ ਆਓ ਅਤੇ ਤੁਸੀਂ ਮੈਥ ਦੇ ਮੈਡਮ ਨਾਲ ਮਿਲ ਕੇ ਗੱਲ ਵੀ ਕਰ ਸਕਦੇ ਹੋ ਉਹ ਦੱਸਣਗੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਅਤੇ ਜੇ ਕੁਛ ਮੈਡਮ 'ਚ ਕਮੀਆਂ ਹੋਣਗੀਆਂ ਉਹ ਵੀ ਅਸੀਂ ਦੇਖਣੀਆਂ ਵਾ ਅਸੀਂ ਵੀ ਉਹ ਵੀ ਸੁਧਾਰ ਕਰਾਂਗੇ

ਹਾਂ ਹਾਂ ਬਿਲਕੁਲ ਆ ਸਕਦੇ ਹੋ ਤੁਸੀਂ ਤੁਸੀਂ ਆ ਜਿਓ ਮੋਸਟ ਵੈਲਕਮ ਤੁਸੀਂ ਆਓ ਸਕੂਲ ਤੁਹਾਨੂੰ ਤੁਹਾਡੀ ਮੈਡਮ ਦੇ ਨਾਲ ਸਾਰੀ ਗੱਲਬਾਤ ਕਰਾ ਦਾਂਗੇ ਅਤੇ ਜੋ ਵੀ ਤੁਹਾਡੀਆਂ ਕੋਈ ਸ਼ਿਕਾਇਤ ਹੋਏਗੀ ਜੋ ਵੀ ਹੈ ਅਸੀਂ ਉਹਨੂੰ ਠੀਕ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਹਾਂ ਬਿਲਕੁਲ ਠੀਕ ਜੀ ਤੁਸੀਂ ਪੌਣੇ ਨੌ ਵਜੇ ਸਕੂਲ ਪਹੁੰਚ ਜਾਣਾ ਓਕੇ ਜੀ ਥੈਂਕ ਯੂ ਥੈਂਕ ਯੂ